ਮੈਂ ਜਦੋਂ ਸਕੂਲ ਵਿੱਚ ਪੜ੍ਹਦਾ ਸਾਂ ਤਾਂ ਸਾਡੇ ਸਕੂਲ ਦੇ ਵਿੱਚ ਇੱਕ ਬਹੁਤ ਹੀ ਵਧੀਆ ਲਾਈਬ੍ਰੇਰੀ ਸੀ ਜਿਸ ਵਿੱਚ ਮੈਂ ਅੱਗੇ ਬੈਠ ਕੇ ਕਿਤਾਬਾਂ ਪੜ੍ਹਿਆ ਕਰਦਾ ਸੀ ਔਰ ਇਸ ਤੋਂ ਬਾਅਦ ਜਦੋਂ ਮੈਂ ਕਾਲਜ ਵਿੱਚ ਦਾਖ਼ਲਾ ਲਿਆ ਤਾਂ ਉੱਥੇ ਵੀ ਇੱਕ ਲਾਈਬ੍ਰੇਰੀ ਸੀ ਜਿਸ ਵਿੱਚ ਜਾ ਕੇ ਵੀ ਮੈਂ ਬੈਠਾ ਰਹਿੰਦਾ ਸੀ ਔਰ ਵਧੀਆ ਤੋਂ ਵਧੀਆ ਕਿਤਾਬਾਂ ਪੜ੍ਹਿਆ ਕਰਦਾ ਸੀ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿਤਾਬਾਂ ਪੜ੍ਹਨ ਵਿੱਚ ਮੇਰੀ ਬਹੁਤ ਹੀ ਰੁਚੀ ਹੈ ਮੈਂ ਪੰਜਾਬੀ ਧਾਰਮਿਕ ਵਿਚਾਰ ਦੀਆਂ ਕਿਤਾਬਾਂ ਨੂੰ ਬਹੁਤ ਹੀ ਪੜ੍ਹਦਾ ਹਾਂ ਮੈਂ ਆਪਣੇ ਘਰ ਵਿੱਚ ਵੀ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਰੱਖੀਆਂ ਹੋਈਆਂ ਹਨ ਔਰ ਮੈਂ ਚਾਹੁੰਦਾ ਹਾਂ ਕਿ ਹੋਰ ਵੀ ਬਹੁਤ ਵਧੀਆ ਤੋਂ ਵਧੀਆ ਕਿਤਾਬਾਂ ਲਿਆ ਕੇ ਉਹਨਾਂ ਨੂੰ ਪੜ੍ਹਾਂ ਔਰ ਆਪਣੇ ਘਰ ਵਿੱਚ ਇੱਕ ਵੱਖਰੀ ਲਾਈਬ੍ਰੇਰੀ ਦੇ ਤੌਰ 'ਤੇ ਵਧੀਆ ਤੋਂ ਵਧੀਆ ਕਿਤਾਬਾਂ ਲਿਆ ਕੇ ਬਹੁਤ ਸਾਰੀ ਕਿਤਾਬਾਂ ਰੱਖਾਂ ਔਰ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਵਿੱਚ ਆਪਣੇ ਇਤਿਹਾਸ ਬਾਰੇ ਜਾਣੂ ਕਰਨ ਵਾਸਤੇ ਕਿਤਾਬਾਂ ਰੱਖਾਂ ਔਰ ਉਹਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਾਂ ਜੋ ਕਿ ਉਹਨਾਂ ਦੀ ਵੀ ਧਾਰਮਿਕ ਕਿਤਾਬਾਂ ਪੜ੍ਹਨ ਵਿੱਚ ਰੁਚੀ ਹੋਵੇ ਔਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਉਹ ਪੜ੍ਹ ਸਕਣ ਔਰ ਇਸ ਬਾਰੇ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ